ਪੰਜਾਬੀ ਭਾਈਚਾਰੇ ਵਿੱਚ ਦਿਵਾਲੀ ਅਤੇ ਹੋਲੀ ਦੋਨੋਂ ਤਿਉਹਾਰ ਹੀ ਧਾਰਮਿਕ ਮਹੱਤਤਾ ਰੱਖਦੇ ਹਨ ਜਿਸ ਕਰਕੇ ਉਹ ਇਹਨਾਂ ਦੋਨਾਂ ਤਿਉਹਾਰਾਂ ਨੂੰ ਹੀ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਜੇਕਰ ਗੱਲ ਕਰੀਏ ਦਿਵਾਲੀ ਦੇ ਤਿਉਹਾਰ ਦੀ ਤਾਂ ਪੰਜਾਬੀਆਂ ਵਿੱਚ ਖਾਸ ਕਰਕੇ ਸਿੱਖਾਂ ਵਿੱਚ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਵੰਜਾ ਰਾਜਿਆਂ ਨੂੰ ਕੈਦ ਵਿੱਚੋਂ ਰਿਹਾਅ ਕਰਵਾਇਆ ਸੀ ਹੋਲੀ ਦੇ ਤਿਉਹਾਰ ਨੂੰ ਵੀ ਪੰਜਾਬੀ ਹੋਲਾ ਮਹੱਲਾ ਦੇ ਨਾਮ ਨਾਲ ਮਨਾਉਂਦੇ ਹਨ ਇਸ ਦਿਨ ਪੰਜਾਬੀ ਲੋਕ ਸਿੱਖਾਂ ਦੇ ਪ੍ਰਸਿੱਧ ਧਾਰਮਿਕ ਸਥਾਨ ਅੰਮ੍ਰਿਤਸਰ ਅਨੰਦਪੁਰ ਸਾਹਿਬ ਆਦਿ ਥਾਵਾਂ ਉੱਪਰ ਧਾਰਮਿਕ ਭਾਵਨਾ ਨਾਲ ਜਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ ਘਰਾਂ ਵਿੱਚ ਵੀ ਲੋਕ ਆਪਣੇ ਆਂਢ ਗੁਆਂਢ ਨਾਲ ਮਿਲ ਕੇ ਇਹ ਤਿਉਹਾਰ ਮਨਾਉਂਦੇ ਹਨ ਇੱਕ ਦੂਜੇ ਨਾਲ ਮਠਿਆਈਆਂ ਦੇ ਰੂਪ ਵਿੱਚ ਪਿਆਰ ਸਾਂਝਾ ਕਰਦੇ ਹਨ